ਪਹਿਲਾਂ ਪਹਿਲ ਰਸੋਈ ਵਿੱਚ ਖਾਣਾ ਬਣਾਉਣ ਲਈ ਬਹੁਤ ਸਮਾਂ ਲੱਗਦਾ ਸੀ ਪਰ ਅੱਜ ਕੱਲ੍ਹ ਪ੍ਰੈਸ਼ਰ ਕੁੱਕਰ ਦੇ ਆਉਣ ਨਾਲ਼ ਖਾਣਾ ਜ਼ਿਆਦਾ ਮਿਕਦਾਰ ਵਿੱਚ ਅਤੇ ਘੱਟ ਸਮੇਂ ਵਿੱਚ ਬਣ ਜਾਂਦਾ ਹੈ ਅਤੇ ਮੈਂ ਸਭ ਨੂੰ ਇਹ ਸੁਝਾਅ ਦੇਵਾਂਗੀ ਕਿ ਜਿੰਨਾਂ ਵੀ ਖਾਣਾ ਬਣਾਉਣਾ ਹੈ ਦਾਲ ਸਬਜ਼ੀ ਉਹ ਪ੍ਰੈਸ਼ਰ ਕੁੱਕਰ ਵਿੱਚ ਬਣਾਈ ਜਾਏ ਇੱਕ ਤਾਂ ਇਹਦੇ ਨਾਲ਼ ਸਮੇਂ ਦੀ ਬੱਚਤ ਹੁੰਦੀ ਹੈ ਦੂਸਰਾ ਇਸਦੇ ਨਾਲ਼ ਗੈਸ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਖਾਣਾ ਵੀ ਸਵਾਦਿਸ਼ਟ ਬਣਦਾ ਹੈ ਸੋ ਮੇਰਾ ਸੁਝਾਅ ਹੈ ਕਿ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਵੇ